ਇੱਕ ਤਕਨੀਕੀ ਉੱਦਮੀ ਦਾ ਜੀਵਨ ਬਦਲਣ ਲਈ ਉਸਦੇ ਨਾਲ ਕੀਤੀ ਵਾਰਤਾਲਾਪ ਤੋਂ ਉਸਦੇ ਕੰਮ ਪ੍ਰਤੀ ਉਸਨੂੰ ਉਤਸ਼ਾਹਿਤ ਕਰਾਂਗਾ ਉਸਨੂੰ ਆਪਣੇ ਕੰਮ ਦਾ ਵਧਾਵਾ ਦੇਣ ਲਈ ਉਸਦੀ ਮਸ਼ਹੂਰੀ ਆਪਣੇ ਸ਼ਹਿਰ ਗਲੀ ਮੁਹੱਲਿਆਂ ਵਿੱਚ ਕਰਾਂਗਾ ਅਤੇ ਵੱਖ ਵੱਖ ਦੂਸਰੇ ਸ਼ਹਿਰਾਂ ਵਿੱਚ ਵੀ ਮਸ਼ਹੂਰੀ ਕਰਵਾਵਾਂਗਾ ਅਤੇ ਲੋਕਾਂ ਨੂੰ ਘੱਟ ਪੈਸਿਆਂ ਵਿੱਚ ਵਧੀਆ ਕੰਮ ਅਤੇ ਵਧੀਆ ਤਕਨੀਕ ਨਾਲ ਲੋਕਾਂ ਨੂੰ ਉਸਦੇ ਕੰਮ ਪ੍ਰਤੀ ਉਤਸ਼ਾਹਿਤ ਕਰਾਂਗਾ ਲੋਕਾਂ ਦਾ ਉਸ ਪ੍ਰਤੀ ਵਿਸ਼ਵਾਸ ਬਣਾਵਾਂਗਾ ਵੀ ਇਹ ਘੱਟ ਪੈਸਿਆਂ ਵਿੱਚ ਵਧੀਆ ਕੰਮ ਕਰੇਗਾ ਅਤੇ ਲੋਕ ਖੁਦ ਉਸਦੇ ਕੰਮ ਨੂੰ ਵੇਖਦੇ ਹੋਏ ਉਸ ਵੱਲ ਖਿੱਚੇ ਆਉਣਗੇ ਉਹ ਕੋਈ ਦੂਸਰਾ ਨਹੀਂ ਮੇਰਾ ਆਪਣਾ ਮਿੱਤਰ ਹੋਏਗਾ ਮੈਂ ਉਸਨੂੰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕਰਾਂਗਾ ਅਤੇ ਨਵੀਂ ਤਕਨੀਕ ਲਿਆਉਣ ਵਾਸਤੇ ਉਸਨੂੰ ਕਹਾਂਗਾ ਤਾਂ ਜੋ ਲੋਕ ਵੀ ਆਪਣੇ ਆਪ ਉਸ ਵੱਲ ਆ ਜਾਣ ਅਤੇ ਮਤਲਬ ਜੋ ਵੀ ਉਹ ਕੰਮ ਕਰੇਗਾ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਸਨੂੰ ਨੂੰ ਹੋਰ ਵਧੀਆ ਅਤੇ ਠੀਕ ਢੰਗ ਨਾਲ ਹੋਰ ਕੰਮ ਵਧਾਉਣ ਲਈ ਉਸਨੂੰ ਪ੍ਰੇਰਿਤ ਕਰਾਂਗਾ ਵੀ ਤਾਂ ਜੋ ਸਮਾਜ ਵਿੱਚ ਲੋਕਾਂ ਨੂੰ ਵੀ ਆਪਣਾ ਕੰਮ ਕਰਾਉਣ ਲਈ ਕੋਈ ਦੂਸਰੇ ਸ਼ਹਿਰ ਜਾਂ ਦੂਸਰੇ ਸ਼ਹਿਰ ਵਿੱਚ ਨਾ ਜਾਣ ਦੀ ਲੋੜ ਪਵੇ ਉਸਨੂੰ ਆਪਣੇ ਹੀ ਸ਼ਹਿਰ ਵਿੱਚ ਸਾਰਾ ਕੰਮ ਵਧੀਆ ਅਤੇ ਘੱਟ ਪੈਸਿਆਂ ਵਿੱਚ ਹੋ ਜਾਵੇ